ਮਨੁੱਖੀ ਸਰੀਰ ਸਾਡੇ ਖਾਣ ਪੀਣ ਤੇ ਨਿਰਭਰ ਕਰਦਾ ਹੈ ਤੇ ਖਾਣ ਪੀਣ ਤੇ ਨਿਰਭਰ ਕਰਦਾ ਤੇ ਵਧੀਆ ਪੈਂਦੀ ਸੀ ਉਹ ਵਧੀਆ ਤਾਜੀ ਸਬਜੀ ਬਿਨਾ ਸਬਜੀ ਖਾ ਕੇ ਕਾਫੀ ਚੰਗਾ ਜਿਮ ਜਿਉਂਦੇ ਸੀ ਆਪਣੀ ਉਮਰਾਂ ਨੇ ਪੂਰਾ ਹੰਡਾਉਂਦੇ ਸੀ ਪਰ ਅਸੀਂ ਅੱਜ ਕੱਲ ਹਰ ਇੱਕ ਚੀਜ਼ ਵਿੱਚ ਮਿਲਾਵਟ ਹੋਣ ਕਰਕੇ ਖਾਦਾ ਰੋੜੀਆਂ ਵਿੱਚ ਵੀ ਮਿਲਾਵਟਾਂ ਪੈਣ ਕਰਕੇ ਸਾਨੂੰ ਕਹਿਣ ਨੂੰ ਤਾਜੀਆਂ ਸਬਜ਼ੀਆਂ ਵਾ ਪਰ ਉਹ ਵੀ ਮਿਲਾਵਟਾਂ ਨਾਲ ਬਣੀਆਂ ਹੁੰਦੀਆਂ ਨਾ ਇਹੋ ਜਿਹੀਆਂ ਸਬਜੀਆਂ ਖਾਣ ਕਰਕੇ ਅਸੀਂ ਕਈ ਤਰ੍ਹਾਂ ਦੀ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਪਏ ਆਂ ਜਿਹਦੇ ਕਰਕੇ ਸਾਡੀ ਮਨੁੱਖੀ ਜੀਵਨ ਦੀ ਉਮਰ ਘੱਟਦੀ ਪਈ ਹੈ ਪਹਿਲੇ ਸਾਡੇ ਪੁਰਖਿਆਂ ਨੂੰ ਤਾਜੀਆਂ ਸਬਜੀਆਂ ਖਾਣ ਕਰਕੇ ਵਧੀਆ ਖਾਦਾਂ ਵਾਲੇ ਸਬਜੀਆਂ ਖਾਣ ਕਰਕੇ ਬਿਮਾਰੀਆਂ ਦਾ ਸਾਹਮਣਾ ਨਹੀ ਸੀ ਕਰਨਾ ਪੈਂਦਾ ਪਰ ਹੁਣ ਅੱਜ ਕੱਲ ਸਾਨੂੰ ਗੰਦੀ ਖਾਦ ਕਰਕੇ ਮਿਲਾਵਟ ਵਾਲੀ ਮਸਾਲਿਆਂ ਵਾਲੀ ਟਿਕਿਆ ਵਾਲੀ ਖਾਦਾ ਕਰਕੇ ਉਹਨਾਂ ਤੋਂ ਬਣੀਆ ਸਬਜੀਆਂ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਦੇ ਹੋਏ ਤੇ ਸਾਡੀ ਉਮਰ ਦਾ ਘਟਦੀ ਪਈ ਹੈ ਅੱਜ ਕੱਲ ਸਾਡੀ ਉਮਰਾਂ ਅੱਧ ਤੋਂ ਵੱਧ ਪੰਜਾਹ ਯਾ ਸੱਠ ਸਾਲ ਦੀ ਉਮਰ ਕਦੋਂ ਸਾਡਾ ਜੀਵਨ ਨਹੀਂ ਰਿਹਾ ਇਹਨੇ ਸਾਡੇ ਸੋ ਸੋ ਸਾਲ ਦੀ ਉਮਰ ਆਲਾ ਹੁੰਦੇ ਸੀ ਤੇ ਆਪਣੇ ਜੀਵਨ ਨੂੰ ਚੰਗੀ ਤਰਾਂ ਹੋ ਗਈ ਸੀ ਤੇ ਅੱਜ ਸਾਨੂੰ ਨਹੀਂ ਰਿਹਾ